ਹਾਂਜੀ ਅੱਜ ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਦੇ ਲੋਕ ਚੰਗੀ ਸਿਹਤ ਬਣਾਈ ਰੱਖਣ ਲਈ ਕੀ ਕੀ ਰੋਕਥਾਮ ਕਰ ਸਕਦੇ ਆ ਕੀ ਕੀ ਉਪਾਅ ਕਰ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਕੀ ਆ ਜਿਹਦੇ 'ਤੇ ਸਾਨੂੰ ਰੋਕ ਲਾਉਣੀ ਚਾਹੀਦੀ ਆ ਪ੍ਰਦੂਸ਼ਣ ਅੱਜ ਕੱਲ੍ਹ ਬਹੁਤ ਵੱਧ ਰਿਹਾ ਜਿਹੜੀਆਂ ਵੀ ਗੱਡੀਆਂ ਸਾਡੇ ਕੋਲ ਡੀਜ਼ਲ ਪੈਟਰੋਲ ਵਾਲੀਆਂ ਉਹ ਸਾਨੂੰ ਸੀ ਐਨ ਜੀ ਜਾਂ ਇਲੈਕਟ੍ਰੋਨਿਕ ਗੱਡੀਆਂ ਲੈਣੀਆਂ ਚਾਹੀਦੀਆਂ ਇਹਦੇ ਨਾਲ ਕੀ ਆ ਪ੍ਰਦੂਸ਼ਣ ਜਿਹੜਾ ਉਹ ਘੱਟ ਹੋਊਗਾ ਕੁਛ ਲੋਕ ਇੱਦਾਂ ਦੇ ਨੇ ਪੰਜਾਬ ਦੇ ਵਿੱਚ ਜਦੋਂ ਅਸੀਂ ਝੋਨਾ ਵੱਢ ਲਿਆ ਜਿਹੜੀ ਉਹਦੀ ਪਰਾਲੀ ਆ ਉਹਨੂੰ ਅੱਗ ਲਾਉਂਦੇ ਆ ਅੱਗ ਦੇ ਨਾਲ ਵੀ ਕੀ ਆ ਪ੍ਰਦੂਸ਼ਣ ਖਰਾਬ ਹੁੰਦਾ ਇਹਦੇ 'ਤੇ ਵੀ ਸਾਨੂੰ ਰੋਕਥਾਮ ਲਾਉਣੀ ਚਾਹੀਦੀ ਆ ਜਿਹੜਾ ਪਾਣੀ ਆ ਸਾਡੇ ਕੋਲ ਸੀਵਰੇਜ ਦਾ ਪਾਣੀ ਹੋ ਗਿਆ ਸ਼ਹਿਰਾਂ ਦੇ ਵਿੱਚ ਉਹ ਥਾਂ ਥਾਂ 'ਤੇ ਜਿੱਥੇ ਲੀਕ ਹੋ ਰਿਹਾ ਉਦੋਂ ਵੀ ਸਾਨੂੰ ਜਿੱਦਾਂ ਕਿ ਕਮੇਟੀ ਬਣੀ ਆ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਰਪੰਚ ਨੇ ਉਹਨਾਂ ਨੂੰ ਦੱਸ ਕੇ ਉਹ ਪਾਣੀ ਦਾ ਵੀ ਇਸਤੇਮਾਲ ਸਾਨੂੰ ਸਹੀ ਤਰੀਕੇ ਦੇ ਨਾਲ ਜਿੱਧਰ ਜਾਣਾ ਉੱਧਰ ਜਾਣਾ ਚਾਹੀਦਾ ਜਿਹੜਾ ਲੀਕ ਜਿਹਾ ਉਹਨੂੰ ਬੰਦ ਹੋਣਾ ਚਾਹੀਦਾ ਦੂਸਰਾ ਜਿਹੜੀ ਟਰੈਫਿਕ ਆ ਗਈ ਅੱਜ ਕੱਲ੍ਹ ਬਹੁਤ ਵੱਧ ਗਈ ਆ ਇਹਦੇ 'ਤੇ ਵੀ ਸਾਨੂੰ ਕੰਟਰੋਲ ਕਰਨਾ ਚਾਹੀਦਾ ਇਹ ਕੁਛ ਰੋਕਥਾਮਾਂ ਸੀਗੀਆਂ ਜਿਹੜੀਆਂ ਅਸੀਂ ਕਰ ਸਕਦੇ ਹਾਂ ਅਗਰ ਇਹਨੂੰ ਅਸੀਂ ਕਰਲਾਂਗੇ ਤਾਂ ਸਾਡੀ ਸਿਹਤ ਆ ਜਿਹੜੀ ਵਧੀਆ ਰਹੂਗੀ ਜਿਹੜੇ ਕੁਦਰਤੀ ਸੋਮੇ ਅੱਜ ਕੱਲ੍ਹ ਉਹਨਾਂ ਨੂੰ ਕੀ ਆ ਬੰਦੇ ਨਸ਼ਟ ਕਰੀ ਜਾਂਦੇ ਆ ਉਹਨਾਂ ਨੂੰ ਰਹਿਣਾ ਚਾਹੀਦਾ ਵੱਧ ਤੋਂ ਵੱਧ ਕੀ ਆ ਦਰਖਤ ਲਾਉਣੇ ਚਾਹੀਦੇ ਆ ਜਿਹਦੇ ਨਾਲ ਕੀ ਆ ਸਾਨੂੰ ਆਕਸੀਜਨ ਮਿਲੇ ਸਾਡਾ ਸਰੀਰ ਹੈ ਜਿਹੜਾ ਉਹ ਵਧੀਆ ਬਣੇ ਦਰਖਤ ਸਾਨੂੰ ਨਹੀਂ ਕੱਟਣੇ ਚਾਹੀਦੇ ਇਹਦੇ 'ਤੇ ਵੀ ਸਰਕਾਰ ਨੂੰ ਕੋਈ ਰੋਕ ਲਾਉਣੀ ਚਾਹੀਦੀ ਆ ਜਿਹੜੇ ਦਰਖਤ ਆ ਇਹ ਨਾ ਕੱਟੇ ਜਾਣ ਦਰਖਤ ਲਗਾਏ ਜਾਣ ਵੱਧ ਤੋਂ ਵੱਧ ਆਪਣੇ ਆਸ ਪਾਸ ਦੀ ਸਾਫ ਸਫਾਈ ਹੋਣੀ ਚਾਹੀਦੀ ਆ ਜਿਵੇਂ ਕਿ ਹੁਣ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਵੀ ਫਾਲਤੂ ਜਾਨਵਰ ਨੇ ਕੁੱਤੇ ਆ ਉਹਨਾਂ 'ਤੇ ਵੀ ਕੀ ਆ ਸਾਨੂੰ ਰੋਕਥਾਮ ਲਾਉਣੀ ਚਾਹੀਦੀ ਹੈ ਜਿਹੜੀ ਉਹ ਗੰਦਗੀ ਫੈਲਾਉਂਦੇ ਆ ਅਗਰ ਇਹਦੇ 'ਤੇ ਕੰਟਰੋਲ ਹੋ ਗਿਆ ਤਾਂ ਸਾਡੀ ਸਿਹਤ ਲਈ ਇਹ ਵੀ ਵਧੀਆ ਚੀਜ਼ ਆ ਇਹਨਾਂ ਦਾ ਅਗਰ ਰੋਕਥਾਮ ਹੋ ਜਾਏ ਸਾਨੂੰ ਹੁਣ ਜੀਵਨ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੈਗੀਆਂ ਜਿਵੇਂ ਬੱਚਿਆਂ ਦੇ ਪਹਿਲਾਂ ਟੀਕੇ ਲੱਗਦੇ ਆ ਉਹ ਸਹੀ ਲਗਾਉਣੇ ਚਾਹੀਦੇ ਆ ਜਿਹੜੀ ਵੀ ਕੋਈ ਸਰਕਾਰ ਵੱਲੋਂ ਹਦਾਇਤ ਆਉਂਦੀ ਆ ਉਹਦਾ ਟੀਕਾਕਰਨ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਜਿਵੇਂ ਕਿ ਕਰੋਨਾ ਦੀ ਬਿਮਾਰੀ ਆਈ ਸੀ ਉਹਦੇ 'ਚ ਦੋ ਦੋ ਡੋਜ਼ਾਂ ਲੱਗੀਆਂ ਨੇ ਤਾਂ ਇਹ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਸੀ ਸਾਨੂੰ ਇਹ ਲਵਾਉਣੀਆਂ ਚਾਹੀਦੀਆਂ ਸੀਗੀਆਂ ਜਿਹੜਾ ਮਿਲਕ ਆ ਸਾਨੂੰ ਉਹ ਜਿਹੜਾ ਵਧੀਆ ਦੁੱਧ ਆ ਉਹਦਾ ਇਸਤੇਮਾਲ ਕਰਨਾ ਚਾਹੀਦਾ ਸਾਡੀ ਸਿਹਤ ਵਾਸਤੇ ਵਧੀਆ ਓਹ ਹਰੇਕ ਵਿਅਕਤੀ ਨੂੰ ਹੈਲਥ ਦੇ ਬਾਰੇ ਐਜੂਕੇਟ ਕਰਨਾ ਚਾਹੀਦਾ ਜਿੰਨੀ ਵੀ ਕਮਿਊਨਟੀ ਆ ਵੀ ਸਾਨੂੰ ਹੈਲਥ ਦੇ ਬਚਾਅ ਲਈ ਸਾਨੂੰ ਕਿਹੜੇ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਕੀ ਕੀ ਸਾਨੂੰ ਕੰਮ ਕਰਨਾ ਚਾਹੀਦਾ ਇਹ ਸਾਨੂੰ ਐਜੂਕੇਸ਼ਨ ਦੇਣੀ ਚਾਹੀਦੀ ਆ ਆਪਣੀ ਕਮਿਊਨਿਟੀ ਨੂੰ ਜਿਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹੇ ਦੂਸਰਾ ਜਿਹੜਾ ਪੀਣ ਵਾਲਾ ਪਾਣੀ ਆ ਉਹ ਸਹੀ ਲੈਣਾ ਚਾਹੀਦਾ ਸਾਨੂੰ ਵਾਟਰ ਵਰਕਸ ਦਾ ਪਾਣੀ ਉਹਦੀ ਚੈੱਕਅਪ ਕਰਾਉਣੀ ਚਾਹੀਦਾ ਆ ਕਿੰਨੇ ਪਰਸੈਂਟ ਗਲਤ ਆ ਕਿੰਨਾ ਸਹੀ ਆ ਉਹ ਅਗਰ ਘਰ ਦੇ ਵਿੱਚ ਵੀ ਤੁਸੀਂ ਆਰ ਓ ਲਗਾਇਆ ਤਾਂ ਵਾਟਰ ਕਟਰ ਵਾਲਾ ਪਾਣੀ ਪੀਓ ਤੁਸੀਂ ਜਿਹਦੇ ਨਾਲ ਤੁਹਾਡੀ ਸਿਹਤ ਬਹੁਤ ਵਧੀਆ ਰਹੂਗੀ ਇਹ ਕੁਝ ਰੋਕਥਾਮਾਂ ਸੀਗੀਆਂ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਕੁਛ ਇੱਦਾਂ ਦੇ ਨਿਯਮ ਆ ਜਿਹੜੇ ਸਾਨੂੰ ਅਪਣਾਉਣੇ ਚਾਹੀਦੇ ਆ ਜਿਵੇਂ ਕਿ ਹੈਲਥ ਐਜੂਕੇਸ਼ਨ ਹੋ ਗਈ ਪਾਣੀ ਦਾ ਬੰਦੋਬਸਤ ਹੋ ਗਿਆ ਵਧੀਆ ਖੁਰਾਕ ਖਾਣੀ ਚਾਹੀਦੀ ਆ ਇਹ ਸਾਰੀਆਂ ਚੀਜ਼ਾਂ 'ਤੇ ਕੀ ਆ ਸਾਨੂੰ ਚੰਗੀ ਸਿਹਤ ਬਣਾਈ ਰੱਖਣ ਲਈ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ